ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੇਰੇ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਸੀ ਕਿ ਮੈਂ ਅੱਗੇ ਕਿਹੜੀ ਪੜ੍ਹਾਈ ਕਰਨੀ ਮੇਰੇ ਕੋਲ ਅੱਗੇ ਬੀ ਕੋਮ ਬੀ ਸੀ ਏ ਬੀ ਬੀ ਏ ਇੱਦਾਂ ਦੇ ਕਾਫ਼ੀ ਸਾਰੇ ਕੋਰਸਿਸ ਸੀਗੇ ਜਿੰਨਾਂ ਵਿਚ ਮੈਂ ਸਿਰਫ਼ ਇੱਕ ਚੂਜ਼ ਕਰਨਾ ਸੀ ਅਤੇ ਜੇ ਇਸ ਲੇ ਇਸ ਲਈ ਮੇਰੇ ਮੇਰੇ ਦਿਮਾਗ਼ ਵਿੱਚ ਕਾਫੀ ਉਹ ਸੀ ਕਿ ਮੈਂ ਕਿਹੜਾ ਇਸ ਚੂਜ਼ ਕਰਾਂ ਕਿ ਜਿਹੜਾ ਮੈਨੂੰ ਆਉਣ ਵਾਲੇ ਸਮੇਂ ਵਿੱਚ ਕੰਮ ਆਵੇ ਇਸ ਲਈ ਮੈਂ ਇਸ ਇਸ ਬਾਰੇ ਮੈਂ ਆਪਣੇ ਤਾਇਆ ਜੀ ਤੋਂ ਕਾਫ਼ੀ ਸਲਾਹ ਲਈ ਉਹਨਾਂ ਨੂੰ ਦੱਸਿਆ ਕਿ ਮੈਂ ਬੈਂਕਿੰਗ ਵਿੱਚ ਜਾਣਾ ਚਾਹੁੰਦੀ ਹਾਂ ਅਤੇ ਫਿਰ ਉਹਨਾਂ ਨੇ ਮੈਨੂੰ ਹਰੇਕ ਕੋਰਸ ਦੀ ਅਲੱਗ ਅਲੱਗ ਮਹੱਤਵਾ ਮਹੱਤਤਾ ਦੱਸੀ ਅਤੇ ਜਿਸ ਲਈ ਫਿਰ ਮੈਂ ਬੀ ਕੋਮ ਕੀਤੀ ਬੀ ਕੋਮ ਕਰਨ ਦੇ ਕਰਨ ਤੋਂ ਬਾਅਦ ਮੈਂ ਬੈਂਕਿੰਗ ਵਿਚ ਵੀ ਜਾ ਸਕਦੀ ਹਾਂ ਅਤੇ ਅੱਗੇ ਮਾਸਟਰ ਡਿਗਰੀ ਕਰਕੇ ਮੈਂ ਬਿਜ਼ਨੈਸ ਲਾਈਨਸ ਵਿੱਚ ਵੀ ਜਾ ਸਕਦੀ ਹਾਂ ਤਾਂ ਇਸ ਲਈ ਇਹ ਮੇਰਾ ਮ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਫ਼ੈਸਲਾ ਸੀਗਾ ਜਿਸ ਵਿੱਚ ਮੈਂ ਬੀ ਕੋਮ ਚੂਜ਼ ਕੀਤੀ